ਅਸੀਂ ਕੈਮਰੇ ਦੇ ਨਾਲ ਜਿਵੇਂ ਕਿ ਉਸ ਵਾਤਾਵਰਨ ਪ੍ਰੇਮੀ ਆ ਨਾ ਇੱਕ ਅਸੀਂ ਅਤੇ ਜਿੱਥੋਂ ਅਸੀਂ ਘੁੰਮਣ ਜਾਂਦੇ ਹਾਂ ਅਤੇ ਉੱਥੇ ਜਾ ਕੇ ਤੇ ਸਾਨੂੰ ਫੋਟੋਗ੍ਰਾਫੀ ਵੀ ਸ਼ੌਂਕ ਆ ਅਤੇ ਫੋਟੋਗ੍ਰਾਫੀ ਸ਼ੌਂਕ ਅਤੇ ਵਾਤਾਵਰਨ ਪ੍ਰੇਮੀ ਇੱਕ ਗੱਲ ਹੀ ਹੁੰਦੀ ਆ ਕਿ ਜਾ ਕੇ ਅਸੀਂ ਵਧੀਆ ਵਧੀਆ ਜਗ੍ਹਾ ਚੂਜ਼ ਕਰਨੀਆਂ ਉੱਥੇ ਅਸੀਂ ਆਪਣੀਆਂ ਫੋਟੋਆਂ ਖਿੱਚਣੀਆਂ ਕਿਸ ਕਿਹੇ ਨਵੇਂ ਥਾਂ 'ਤੇ ਜਾਣਾ ਘੁੰਮਣ ਫਿਰਨ ਵਾਸਤੇ ਅਤੇ ਅਸੀਂ ਉਹਨੂੰ ਇਕ ਯਾਦਗਾਰ ਦਾ ਪਲ ਬਣਾ ਲੈਣਾ ਇਸ ਕਰਕੇ ਅਸੀਂ ਇਹਨੂੰ ਉੱਥੇ ਫੋਟੋ ਕੈਪਚਰ ਕਰਨੀਆਂ ਵੀ ਸਾਨੂੰ ਯਾਦ ਰਹਿਣ ਕਿ ਅਸੀਂ ਇੱਥੇ ਗਏ ਸੀ ਅਤੇ ਕੋਈ ਚੀਜ਼ ਵਧੀਆ ਲੱਗੀ ਨੇਚਰ ਵਧੀਆ ਲੱਗਾ ਕੁਦਰਤ ਕੁਦਰਤ ਦੀ ਜਗ੍ਹਾ ਜਿਹੜੀ ਵਧੀਆ ਲੱਗੀ ਉੱਥੋਂ ਦੇ ਫ਼ਲ ਫੁੱਲ ਬੂਟੇ ਸੋਹਣੇ ਲੱਗੇ ਉੱਥੋਂ ਦੀ ਫੋਟੋ ਖਿੱਚੀ ਗਾਰਡਨ ਦੀਆਂ ਤਸਵੀਰਾਂ ਖਿੱਚੀਆਂ ਅਸੀਂ ਘੁੰਮਣ ਵਾਸਤੇ ਹਰਮੰਦਰ ਸਾਹਿਬ ਗਏ ਹਾਂ ਉੱਥੋਂ ਦੀਆਂ ਫੋਟੋਆਂ ਖਿੱਚੀਆਂ ਜਲ੍ਹਿਆਂਵਾਲਾ ਬਾਗ ਗਏ ਉੱਥੋਂ ਦੀਆਂ ਖਿੱਚੀਆਂ ਹਰਿਮੰਦਰ ਸਾਹਿਬ ਫੋਟੋਆਂ ਖਿੱਚੀਆਂ ਕਿ ਅਸੀਂ ਆਪਣੇ ਆਉਣ ਵਾਲੇ ਸਮੇਂ 'ਚ ਇੱਕ ਸੇਧ ਦੇ ਸਕੀਏ ਜੋ ਕਿ ਸਾਡਾ ਅਸਥਾਨ ਹੈ ਇੱਕ ਤੇ ਆਉਣ ਵਾਲੇ ਅਗਾਂਹ ਬੱਚਿਆਂ ਨੂੰ ਵੀ ਦਿਖਾਉਣ ਵਾਸਤੇ ਵੀ ਅਸੀਂ ਜਾਂਦੇ ਸੀ ਦਿਖਾ ਵੀ ਸਕਦੇ ਹਾਂ ਉੱਥੇ ਘੁਮਾਉਣ ਵੀ ਲੈ ਜਾਵਾਂਗੇ ਉਸ ਤੋਂ ਬਾਅਦ ਅਸੀਂ ਜਲ੍ਹਿਆਂਵਾਲੇ ਬਾਗ ਜਾਂਦੇ ਹਾਂ ਉੱਥੇ ਇੱਕ ਹਿਸਟੋਰੀਕਲ ਹੈ ਜਿਵੇਂ ਗੋਲੀਆਂ ਚੱਲੀਆਂ ਸੀ ਜੀ ਅਤੇ ਉੱਥੋਂ ਦੀ ਇਕ ਹਿਸਟਰੀ ਹੈ ਉਹਨੂੰ ਕੈਪਚਰ ਕਰਾਂਗੇ ਕੈਪਚਰ ਕਰ ਕੇ ਉਹਨੂੰ ਉਸ 'ਤੇ ਲੈ ਕੇ ਆਵਾਂਗੇ ਫਿਰ ਅਸੀਂ ਬੱਚਿਆਂ ਨੂੰ ਬਸ ਸੇਧ ਦੇਵਾਂਗੇ ਇਹਨਾਂ ਚੀਜ਼ਾਂ ਨਾਲ ਅਤੇ ਇਸ ਕਰਕੇ ਅਸੀਂ ਇਹ ਤਸਵੀਰਾਂ ਵਧੀਆ ਤਰੀਕੇ ਵਾਲੀਆਂ ਖਿੱਚਦੇ ਹਾਂ ਅਤੇ ਜਿਨ੍ਹਾਂ ਨਾਲ ਸਾਨੂੰ ਇੱਕ ਜ਼ਿੰਦਗੀ 'ਚ ਸੇਧ ਮਿਲੇ